ਸਾਡੇ ਪਿੰਡ ਵਿੱਚ ਹਰ ਬਿਮਾਰੀ ਦੇ ਇਲਾਜ ਲਈ ਘਰੇਲੂ ਨੁਸਖੇ ਵਰਤੇ ਜਾਂਦੇ ਹਨ ਪਿੰਡ ਦੇ ਬਜ਼ੁਰਗ ਇਹ ਘਰੇਲੂ ਨੁਸਖਿਆਂ ਬਾਰੇ ਜਾਣਦੇ ਹਨ ਅਤੇ ਉਹ ਇਨ੍ਹਾਂ ਦੀ ਜਾਣਕਾਰੀ ਹਰ ਪਿੰਡ ਦੇ ਵਸਨੀਕ ਨੂੰ ਦੇ ਦਿੰਦੇ ਹਨ ਜਿਵੇਂ ਕਿ ਕਬਜ਼ ਦੇ ਇਲਾਜ ਦੇ ਲਈ ਦਹੀਂ ਵਿੱਚ ਮਿੱਠਾ ਪਾ ਕੇ ਖ ਖਾਧਾ ਜਾ ਸਕਦਾ ਹੈ ਇਸ ਤੋਂ ਬਿਨਾਂ ਤਰਲ ਪਦਾਰਥ ਜਿਵੇਂ ਕਿ ਪਾਣੀ ਹੋਇਆ ਜੂਸ ਹੋਇਆ ਇਹ ਚੀਜ਼ਾਂ ਨੂੰ ਵੱਧ ਲਿਆ ਜਾਂਦਾ ਹੈ ਮਿੱਠਾ ਸੋਡਾ ਵੀ ਅਸੀਂ ਕਬਜ਼ ਦੇ ਇਲਾਜ ਲਈ ਵਰਤ ਸਕਦੇ ਹਾਂ ਇਸ ਤੋਂ ਬਿਨਾਂ ਦਹੀਂ ਦੇ ਵਿੱਚ ਇਸਬਗੋਲ ਨੂੰ ਘੋਲ ਕੇ ਪੀਤਾ ਜਾ ਖਾਇਆ ਜਾ ਸਕਦਾ ਹੈ ਦੁੱਧ ਦੇ ਵਿੱਚ ਘੀ ਪਾ ਕੇ ਵੀ ਖਾਇਆ ਜਾ ਸਕਦਾ ਹੈ ਜਿਹਦੇ ਨਾਲ ਕਿ ਕਬਜ਼ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ ਇਸ ਤਰ੍ਹਾਂ ਦੇ ਕਈ ਬਹੁਤ ਸਾਰੇ ਪੈ ਇਹੋ ਜੇ ਇਹ ਨੁਸਖੇ ਹਨ ਜੋ ਪਿੰਡ ਦੇ ਬਜ਼ੁਰਗਾਂ ਵੱਲੋਂ ਦੱਸੇ ਜਾਂਦੇ ਹਨ ਤਾਂ ਕਿ ਹਰ ਬਿਮਾਰੀ ਦਾ ਇਲਾਜ ਪਿੰਡ ਵਿੱਚ ਹੀ ਹੋ ਸਕੇ